ਮੇਰੇ ਕੋਲ ਮੈਸੇਜ ਆਇਆ ਮੈਂ ਤਿੰਨ ਸੌ ਰੁਪਈਆ ਪਵਾਇਆ ਸੀ ਮਬੈਲ 'ਚ ਅਤੇ ਮੇਰਾ ਚਾਰ ਸੌ ਪੈ ਗਿਆ ਉਹ ਕੋਈ ਪਤਾ ਨਹੀਂ ਵੀ ਗਲਤੀ ਨਾਲ ਪਿਆ ਕੋ ਉਹਨਾਂ ਨੇ ਕੋਈ ਸਕੀਮ ਹੈ ਤਾਂ ਪਾਇਆ ਅਤੇ ਮੇਰਾ ਫੋਨ ਨੰਬਰ ਹੈਗਾ ਚੁਰਾਨਵੇਂ ਪੰਜ ਸੌ ਪਚਵੰਜਾ ਜੀਰੋ ਤੇਰਾਂ ਜੀਰੋ ਤੇਰਾਂ ਪਚਵੰਜਾ ਪਤਾ ਨਹੀਂ ਗਲਤੀ ਨਾਲ ਪੈ ਗਿਆ ਮੈਂ ਆਪਣੀ ਸਹੇਲੀ ਨਾਲ ਗੱਲਬਾਤ ਕਰੀ ਸੀ ਉਹ ਕਹਿੰਦੀ ਕੋਈ ਪਤਾ ਨਹੀਂ ਬੇ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਨਾਲ ਜਾਂ ਕੋਪਨੀ ਕਨੀਓ ਪਿਆ ਕਿ ਜਾਂ ਉਹਨਾਂ ਨੇ ਆਪ ਪਾਤਾ ਗਲਤੀ ਨਾਲ ਫਿਰ ਦੇਖੋ ਕਿਸ ਤਰ੍ਹਾਂ ਬਣ ਰਿਹਾ ਕਿ ਮੈਨੂੰ ਦੇ ਰਹੇ ਕਿ ਜਾਂ ਨਾ ਦੇ ਰਹੇ